ਖਬਰਾਂ ਵਿੱਚ ਕਈ ਤਰ੍ਹਾਂ ਦੇ ਸਮਾਜਿਕ ਅਤੇ ਸੱਭਿਆਚਾਰਕ ਮੁੱਦੇ ਨਜ਼ਰਾਂ ਵਿੱਚ ਨਹੀਂ ਆਉਂਦੇ ਹਨ ਜਿਵੇਂ ਜਾਤੀਵਾਦ ਲਿੰਗ ਸਮਾਨਤਾ ਜਲਵਾਯੂ ਵੱਧ ਰਹੀ ਦਿਮਾਗੀ ਪਰੇਸ਼ਾਨੀਆਂ ਅਤੇ ਹੋਰ ਕੋਈ ਮੁੱਦੇ ਹਨ ਖਬਰਾਂ ਵਿੱਚ ਜ਼ਿਆਦਾਤਰ ਸਰਕਾਰ ਦੇ ਦੁਆਰਾ ਕੀਤੇ ਹੋਏ ਕੰਮਾਂ ਨੂੰ ਜੋ ਸਰਕਾਰ ਦਿਖਾਉਂਦੀ ਚਾਹੁੰਦੀ ਹੈ ਸਿਰਫ ਉਹਨਾਂ ਨੂੰ ਹੀ ਹਾਈਲਾਈਟ ਕੀਤਾ ਜਾਂਦਾ ਹੈ ਅੱਜ ਕੱਲ੍ਹ ਮੀਡੀਆ ਅਸਲ ਵਿੱਚ ਸਰਕਾਰ ਵਿੱਚ ਹੋਣ ਵਾਲੀਆਂ ਚੋਣਾਂ ਦੂਜੇ ਦੇਸ਼ਾਂ ਦੀਆਂ ਕਮਜ਼ੋਰੀਆਂ ਉਹਨਾਂ ਦੀਆਂ ਲੜਾਈਆਂ ਝਗੜੇ ਦੂਜੇ ਦੇਸ਼ ਦੀਆਂ ਨਾਕਾਮਯਾਬੀਆਂ ਹੀ ਦਿਖਾਉਂਦੀਆਂ ਜਾਂਦੀਆਂ ਹਨ ਅਸਲ ਵਿੱਚ ਖਬਰਾਂ ਦਾ ਕੰਮ ਦੇਸ਼ ਵਿੱਚ ਹੋਣ ਵਾਲੀਆਂ ਕਮੀਆਂ ਜਾਂ ਦੇਸ਼ ਦੇ ਹਾਲਾਤ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ ਦੇਸ਼ ਦੀ ਗਰੀਬੀ ਬੇਰੁਜ਼ਗਾਰੀ ਵੱਧ ਰਹੀ ਭ੍ਰਿਸ਼ਟਾਚਾਰ ਜਾਤੀਵਾਦ ਬਾਰੇ ਕੋਈ ਵੀ ਮੀਡੀਆ ਗੱਲ ਨਹੀਂ ਕਰਦਾ